ਹੈਲੋ ਹਾਂਜੀ ਹਾਂਜੀ ਸਰਕਾਰੀ ਹੋਸਪੀਟਲ 'ਚ ਬੋਲ ਰਹੇ ਹਾਂ ਹਾਂਜੀ ਕੀ ਪ੍ਰੋਬਲਮ ਹਾਂਜੀ ਵਧੀਆ ਦਵਾਈ ਮਿਲਦੀ ਹੈ ਜੀ ਅੱਛਾ ਜੀ ਤੁਸੀਂ ਹੋਰ ਕਿਤੋਂ ਦਵਾਈ ਲਈ ਹੈ ਕਦੇ ਅੱਛਾ ਜੀ ਅਤੇ ਪ੍ਰੋਬਲਮ ਕਦੋਂ ਦੀ ਆ ਅੱਛਾ ਜੀ ਅਤੇ ਅਟਰਾ ਟੂ ਅਕਟਰਾਸਾਊਂਡ ਕਰਵਾਇਆ ਤੁਸੀਂ ਨੇ ਅੱਛਾ ਜੀ ਕੋਈ ਨਾ ਜੀ ਅਕਟਰਾਸਾਊਂਡ ਵੀ ਕਰ ਦੇਵਾਂਗੇ ਅਤੇ ਤੁਸੀਂ ਆ ਜਿਓ ਹੋਸਪਿਟਲ 'ਚ ਡਾਕਟਰ ਨਾਲ ਗੱਲ ਕਰ ਲਿਓ ਛੁੱਟੀ ਜੀ ਦੋ ਵਜੇ ਹੁੰਦੀ ਹੈ ਅਤੇ ਸੈਟਰਡੇ ਨੂੰ ਤਾਂ ਦੋ ਵਜੇ ਛੁੱਟੀ ਹੁੰਦੀ ਆ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਹੈਗੀ ਦ ਨੌ ਦਸ ਵਜੇ ਸਾਡਾ ਹੋਸਪਿਟਲ ਖੁੱਲ੍ਹ ਜਾਂਦਾ ਜੀ ਹਾਂਜੀ ਹਾਂਜੀ ਤੁਸੀਂ ਕਿਹੜੇ ਪਿੰਡ ਤੋਂ ਹੋ ਜੀ ਅੱਛਾ ਜੀ ਅਤੇ ਮੈਡੀਕਲ ਨਾ ਹੁੰਦਾ ਆਪਣੇ ਹੋਸਪਿਟਲ ਦੇ ਵਿੱਚ ਹੀ ਮਿਲੇਗੀ ਹਾਂਜੀ ਦਵਾਈ ਅਤੇ ਜੀ ਹੋਰ ਹਾਂਜੀ ਫੀਸ ਜੀ ਦੇਖ ਲਵਾਂਗੇ ਜੇ ਤੁਸੀਂ ਆ ਗਏ ਐਕਟਰਾਸਾਊਂਡ ਕਰਵਾ ਕੇ ਟੈਸਟ ਕਰਵਾ ਕੇ ਸਾਰੇ ਫੇਰ ਦੇਖ ਲਵਾਂਗੇ ਵੀ ਕਿੰਨੀ ਫੀਸ ਹੋਊਗੀ ਹਾਂਜੀ ਹੋਰ ਜੀ ਤੁਹਾਨੂੰ ਕੋਈ ਦਵਾਈ ਦਬੂਈ ਕੋਈ ਇੱਦਾਂ ਤਾਂ ਨਹੀਂ ਹੈਗਾ ਵੀ ਚੱਕਰ ਚੁੱਕਰ ਆਉਂਦੇ ਆ ਅੱਛਾ ਜੀ ਅਤੇ ਕੋਈ ਹੋਰ ਟੈਸਟ ਕਰਵਾਇਆ ਕਦੇ ਅੱਛਾ ਜੀ ਅਤੇ ਹੋਰ ਡਾਕਟਰ ਨ ਡਾਕਟਰ ਨੂੰ ਤੁਸੀਂ ਸੁਬਾਹ ਮਿਲ ਲਿਓ ਨੌ ਵਜੇ ਤੋਂ ਦੋ ਵਜੇ ਦੋ ਤਿੰਨ ਵਜੇ ਤੱਕ ਹੁੰਦਾ ਹੈ ਖੁੱਲ੍ਹਾ ਹੁੰਦਾ ਜੀ ਅਤੇ ਸਾਢੇ ਬਾਰ੍ਹਾਂ ਵਜੇ 'ਤੇ ਉਹ ਡਾਕਟਰ ਜੀ ਲੰਚ 'ਤੇ ਵਗ ਜਾਂਦੇ ਨੇ ਹਾਂਜੀ ਹਾਂਜੀ ਪਹਿਲਾਂ ਹੀ ਆਇਓ ਜੀ ਤੁਸੀਂ ਹਾਂਜੀ ਅਤੇ ਟੈਸਟ ਵੀ ਹੋਣਗੇ ਤੁਹਾਡੇ ਅਤੇ ਉਹਦਾ ਆਪਾਂ ਦੇਖ ਲਵਾਂਗੇ ਜੀ ਹਾਂਜੀ ਠੀਕ ਹੈ ਜੀ ਹੋਰ ਤੁਸੀਂ ਪਰਚੀ ਪੁੱਰਚੀ ਕਟਵਾ ਲਿਓ ਪਹਿਲਾਂ ਆ ਕੇ ਜੀ ਹਾਂਜੀ ਤੁਹਾਡਾ ਨਾਮ ਦੱਸ ਦਿਉ ਜੀ ਹਾਂਜੀ ਕਿੱਥੋਂ ਦੇ ਠੀਕ ਹੈ ਜੀ ਹੋਰ ਤੁਸੀਂ ਨੇ ਜਦੋਂ ਆਉਣਾ ਹੋਏ ਨਾ ਸਾਨੂੰ ਫੋਨ ਕਰ ਦਿਓ ਉਦੋਂ ਆ ਜਿਓ ਸਾਨੂੰ ਦੱਸ ਦਿਓ ਹਾਂਜੀ ਅਤੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਜਲਦੀ ਆਉਣ ਦੀ ਕੋਸ਼ਿਸ਼ ਕਰਿਓ ਹਾਂਜੀ ਠੀਕ ਹੈ ਧੰਨਵਾਦ